ਜਿਵੇਂ ਕਿ ਤੁਸੀਂ ਜਾਣਦੇ ਹੋ ਵਲਡ ਦੇ ਸੱਤਵੇਂ ਨੰਬਰ 'ਤੇ ਪੰਜਾਬੀ ਭਾਸ਼ਾ ਨੂੰ ਮੰਨਿਆ ਜਾਂਦਾ ਹੈ ਅਤੇ ਤੁਸੀਂ ਦੇਖਿਆ ਹੀ ਹੋਵੇਗਾ ਪੰਜਾਬ ਦੇ ਲੋਕ ਬਾਹਰ ਜਾ ਕੇ ਰਹਿੰਦੇ ਹਨ ਅਤੇ ਕੰਮਕਾਰ ਕਰਦੇ ਹਨ ਅਤੇ ਉੱਥੇ ਉਹ ਪੰਜਾਬੀ ਵੀ ਬੋਲਦੇ ਹਨ ਅਤੇ ਬਾਕੀ ਅੱਜ ਕੱਲ੍ਹ ਨਿਊ ਟ੍ਰੈਂਡਿੰਗ ਸੌਗ 'ਚ ਵੀ ਪੰਜਾਬੀ ਭਾਸ਼ਾ ਦੇ ਵਿੱਚ ਜੋ ਗੀਤ ਆ ਰਹੇ ਹਨ ਉਹ ਹਿੰਦੀ ਗੀਤਾਂ ਨਾਲ਼ੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਨੇ ਅਤੇ ਇਵੇਂ ਹਿੰਦੀ ਭਾਸ਼ਾ ਦੇ ਬਰਾਬਰ ਪੰਜਾਬੀ ਭਾਸ਼ਾ ਦਾ ਫੈਲਾਉ ਹੋ ਰਿਹਾ ਹੈ